ਹੈਲੋ ਨਮਸਤੇ ਹੁਸ਼ਿਆਰਪੁਰੋਂ ਕੋਣ ਬੋਲਦੇ ਤੁਸੀਂ ਨਿਊਜ਼ ਰਿਪੋਟਰ ਅੱਛਾ ਅੱਛਾ

ਇੱਥੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਾਣੀ ਦਾ ਪ੍ਰਬੰਧ ਤਾਂ ਠੀਕ ਠਾਕ ਆ ਜੀ ਪਾਣੀ ਦੋ ਟੈਮ ਆਉਂਦਾ ਸਰਕਾਰੀ ਟੂਟੀਆਂ ਦੇ ਵਿੱਚ ਅਤੇ ਬਿਜਲੀ ਦਾ ਵੀ ਠੀਕ ਹੀ ਆ ਬਿਜਲੀ ਵੀ ਠੀਕ ਆ ਬਿਜਲੀ ਤਾਂ ਚਲੋ ਇੰਨਾਂ ਵੀ ਗਰਮੀਆਂ ਦੇ ਵਿੱਚ ਬਿੱਲ ਵਗੈਰਾ ਜ਼ਿਆਦਾ ਆਉਂਦੇ ਆ ਅਤੇ ਫਿਊਜ਼ ਫਿਆਜ਼ ਉੜੇ ਰਹਿੰਦੇ ਆ ਪਰ ਵਧੀਆ ਕਾਰਗੁਜ਼ਾਰੀ ਆ ਬਿਜਲੀ ਮਹਿਕਮੇ ਦੀ ਜਦੋਂ ਫੋਨ ਕਰੋ ਕੰਪਲੇਂਟ ਲਿਖਾ ਦੀ ਦੀ ਆ ਅਤੇ ਉਹ ਆਪਣਾ ਆ ਕੇ ਆਪਣੀ ਜੋ ਵੀ ਰਿਪੇਅਰ ਵਗੈਰਾ

ਹਾਂਜੀ ਹਾਂਜੀ ਅਤੇ ਬਾਕੀ ਰਿਪੇਅਰ ਵੈਗਰਾ ਟੈਮ ਨਾਲ ਦੀ ਨਾਲ ਆ ਜਾਂਦੇ ਆ ਕੰਪਲੇਂਟ ਲਿਖਾ ਦੋ ਫੋਨ ਦੇ ਉੱਤੇ ਸਾਰਾ ਕੰਮ ਹੋ ਜਾਂਦਾ ਅਤੇ ਪਾਣੀ ਵੀ ਠੀਕ ਆ ਪਾਣੀ ਦਾ ਪ੍ਰਬੰਧ ਵੀ ਪੂਰਾ ਆ ਸਰਕਾਰੀ ਟੂਟੀਆਂ ਦੇ ਵਿੱਚ ਪਾਣੀ ਟੈਮ ਸਿਰ ਆਉਂਦਾ

ਸੜਕਾਂ ਵੀ ਇੱਧਰ ਤਾਂ ਠੀਕ ਹੀ ਆ ਟਾਂਡਾ ਰੋਡ ਵੱਲ ਨੂੰ ਠੀਕ ਆ ਪਰ ਜਿਵੇਂ ਥੋੜ੍ਹਾ ਇੱਧਰ ਨੂੰ ਅੱਗੇ ਨੂੰ ਜਾਂਦੇ ਆ ਆਪਣੇ ਰੋਈਏ ਚੌਂਕ ਵੱਲ ਨੂੰ ਉੱਥੇ ਅੱਗੇ ਵੀ ਇੱਕ ਰਿਪੋਟਰ ਆਇਆ ਸੀਗਾ ਉਹਨੇ ਰਿਪੋਰਟ ਕੀਤਾ ਸੀ ਚੈਨਲ ਦੇ ਵਿੱਚ ਅਤੇ ਉਹ ਵੀਡੀਓ ਵਗੈਰਾ ਪਾਈ ਸੀਗੀ ਚੈਨਲ 'ਤੇ ਵੀ ਕਾਫੀ ਚੱਲੀ ਲੋਕੀ ਬਹੁਤ ਪਰੇਸ਼ਾਨ ਆ ਉਤੋਂ ਟੋਏ ਗੱਡੀਆਂ ਵੀ ਟੁੱਟੀਆਂ ਉਹਨਾਂ ਦੀਆਂ ਉਂ ਵੀ ਟੋਏ ਵਗੈਰਾ ਜ਼ਿਆਦਾ ਨਾ ਉੱਥੇ ਅਤੇ ਫਿਰ ਐਕਸੀਡੈਂਟ ਦਾ ਖਤਰਾ ਵੀ ਰਹਿੰਦਾ ਉੱਥੇ ਕੋਈ ਸਕੂਟਰ ਮੋਟਰਸਾਈਕਲ 'ਤੇ ਜਾਂਦਾ ਪਾਣੀ ਦਾ ਪ੍ਰਬੰਧ ਵੀ ਵਧੀਆ ਬਸ ਇਹੀ ਆ ਵੀ ਵਿੱਚ ਵਿੱਚ ਕਿਤੇ ਰੋਡ ਹੈਗੇ ਆ ਜਿੱਥੇ ਸਰਕਾਰ ਨੂੰ ਚਾਹੀਦਾ ਬਈ ਟੈਮ ਸਿਰ ਉੱਥੇ ਰਿਪੇਅਰ ਕਰਾਈ ਜਾਵੇ ਕਿਉਂਕਿ ਰਾਤ ਬਰਾਤੇ ਕੋਈ ਸਕੂਟਰ ਮੋਟਰਸਾਈਕਲ 'ਤੇ ਜਾਂਦਾ ਟੋਏ ਦੇ ਵਿੱਚ ਜਦੋਂ ਮੋਟਰਸਾਈਕਲ ਵੱਜਦਾ ਅਤੇ ਉਦੋਂ ਡਿੱਗਣ ਦੇ ਚਾਂਸ ਹੁੰਦੇ ਆ ਪਿੱਛੋਂ ਕੋਈ ਗੱਡੀ ਤੇਜ਼ ਆਉਂਦੀ ਆ ਉਹ ਵੀ ਉੱਤੇ ਉਹਨਾਂ ਦੇ ਚੜ੍ਹ ਸਕਦੀ ਆ ਜਿਹੜੇ ਉਹ ਹਾਦਸੇ ਦਾ ਖਤਰੇ ਦਾ ਘਰ ਆ ਉਹ ਉਹ ਪਹਿਲਾਂ ਵੀ ਇੱਕ ਰਿਪੋਟਰ ਆ ਕੇ ਆਪਣੀ ਮਤਲਬ ਉਹਨੇ ਰਿਪੋਰਟ ਕੀਤਾ ਸੀ ਹਾਂ ਪਰ ਉਹ ਕਰਨਾ ਚਾਹੀਦਾ ਤੁਹਾਨੂੰ ਨਿਊਜ਼ ਚੈਨਲ 'ਚ ਚਲਾਉਣਾ ਚਾਹੀਦਾ ਵੀ ਦੱਸਣਾ ਚਾਹੀਦਾ ਲੋਕਾਂ ਨੂੰ ਬਈ ਸਰਕਾਰ ਦੀ ਕਾਰਗੁਜ਼ਾਰੀ ਕੀ ਆ ਤੁਸੀਂ ਵੀ ਇੱਕ ਦਿਨ ਲਗਾ ਕੇ ਉੱਥੇ ਕਵਰੇਜ਼ ਕਰੋ ਆਪਣੀ ਸੜਕ ਦਾ ਤੁਸੀਂ ਦੋਖੇ ਆ ਕੇ ਕੀ ਹਾਲ ਹੋਇਆ ਅਤੇ ਬਿਜਲੀ ਪਾਣੀ ਤਾਂ ਚਲੋ ਠੀਕ ਹੀ ਆ ਬਿਜਲੀ ਪਾਣੀ ਗਰਮੀਆਂ ਦੇ ਵਿੱਚ ਥੋੜ੍ਹੀ ਦਿੱਕਤ ਹੁੰਦੀ ਆ ਜਦੋਂ ਲੋੜ ਵੱਧ ਜਾਂਦਾ ਘੱਟ ਜਾਂਦਾ ਨਹੀਂ ਹੁਣ ਤਾਂ ਨਹੀਂ ਲੱਗਦੇ ਗਰਮੀਆਂ ਦਾ ਹੁਣ ਪਤਾ ਨਹੀਂ ਅੱਗੇ ਦੇਖੋ ਹੁਣ ਤਾਂ ਠੀਕ ਠਾਕ ਏ ਹਾਂ ਠੀਕ ਕਰ ਦਿੰਦੇ ਉਹਨਾਂ ਨੇ ਨੰਬਰ ਦਿੱਤੇ ਓ ਆ ਹੈਲਪਲਾਈਨ ਨੰਬਰ ਉਹਨਾਂ 'ਤੇ ਫੋਨ ਕਰਦੋ ਜਦੋਂ ਕੋਈ ਖਰਾਬ ਹੋ ਜਾਂਦੀ ਤਾਂ ਉਹ ਟੈਮ ਸਿਰ ਆ ਕੇ ਹਾਂ ਠੀਕ ਆ ਜੀ

ਚਲੋ ਠੀਕ ਆ ਜੀ ਠੀਕ ਆ ਜੀ